ਸਫਾਈ ਦਾ ਕੰਮ ਸਾਨੂੰ ਆਪਣੇ ਘਰ ਤੋਂ ਹੀ ਸ਼ੁਰੂ ਕਰਨਾ ਚਾਹੀਦਾ ਹੈ ਅਸੀਂ ਆਪਣੇ ਮੁਹੱਲੇ ਵਿੱਚ ਸਾਫ਼ ਸਫਾਈ ਵਾਸਤੇ ਡਸਟਬੀਨ ਰੱਖੇ ਹੋਏ ਹਨ ਅਤੇ ਆਉਂਦੇ ਜਾਂਦੇ ਅਗਰ ਨੇੜੇ ਤੇੜੇ ਕੋਈ ਕੂੜਾ ਕਰਕਟ ਪਿਆ ਹੈ ਤਾਂ ਚੱਕ ਕੇ ਉਹ ਡਸਟਬੀਨ 'ਚ ਪਾ ਦੇਈ ਦਾ ਹੈ ਹੋਰ ਮੁਹੱਲੇ ਵਿੱਚ ਆਲੇ ਦੁਆਲੇ ਵੱਧ ਤੋਂ ਵੱਧ ਪੇੜ ਪੌਦੇ ਲਗਵਾਏ ਹੈ ਜਿਸ ਨਾਲ ਹਰਿਆਲੀ ਰਹੇ ਆਪਣੀ ਕਲੋਨੀ ਵਿੱਚ ਅਸੀਂ ਇੱਕ ਸਫਾਈ ਕਰਮਚਾਰੀ ਵੀ ਨਿਯੁਕਤ ਕੀਤਾ ਹੋਇਆ ਜੋ ਕਿ ਸਾਰੇ ਮਹੱਲੇ ਦੀਆਂ ਗਲੀਆਂ ਨੂੰ ਹਰ ਰੋਜ਼ ਸਾਫ਼ ਕਰਦਾ ਹੈ ਅਤੇ ਥਾਂ ਥਾਂ 'ਤੇ ਡਸਟਬੀਨ ਰੱਖੇ ਹੋਏ ਹਨ ਜੋ ਵੀ ਆਲੇ ਦੁਆਲੇ ਦੇ ਘਰਾਂ ਵਾਲੇ ਲੋਕ ਡਸਟਬੀਨ 'ਚ ਹੀ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਡਸਟਬੀਨਾਂ 'ਚ ਪਾਉਣ ਅਤੇ ਮੁਹੱਲੇ ਵਿੱਚ ਹਰ ਹਫਤੇ ਦਵਾਈ ਦਾ ਛਿੜਕਾਓ ਕਰਾਇਆ ਜਾਂਦਾ ਹੈ ਜਿਸ ਨਾਲ ਕਿ ਵੀ ਮੁਹੱਲੇ 'ਚ ਮੱਛਰ ਅਤੇ ਮੱਖੀਆਂ ਜ਼ਿਆਦਾ ਨਾ ਫੈਲ ਸਕਣ ਲੋਕਾਂ ਬਿਮਾਰੀ ਤੋਂ ਬਚੇ ਰਹਿਣ ਅਗਰ ਕਿਸੇ ਜਗ੍ਹਾ ਪਾਣੀ ਖੜੇਗਾ ਤਾਂ ਉਹਦੇ ਨਾਲ ਮੱਛਰ ਪੈਦਾ ਹੁੰਦਾ ਹੈ ਮੁਹੱਲੇ 'ਚ ਕਿਤੇ ਪਾਣੀ ਨਹੀਂ ਖੜਨ ਦੇਈ ਦਾ ਟਾਇਮ ਸਿਰ ਮਿਉਂਸੀਪਲ ਵਾਲਿਆਂ ਤੋਂ ਗਟਰ ਵਗੈਰਾ ਦੀ ਸਫਾਈ ਵੀ ਕਰਾਉਂਦੇ ਰਹਿੰਦੇ ਹਾਂ ਹੋਰ ਨੇੜੇ ਤੇੜੇ ਕਿਸੇ ਨੂੰ ਵੀ ਅਗਰ ਕੂੜਾ ਸੁੱਟਦੇ ਦੇਖਦੇ ਹਾਂ ਤਾਂ ਉਹਨੂੰ ਉਹ ਉਹਤੇ ਜੁਰਮਾਨਾ ਪਾ ਕੇ ਉਹਨੂੰ ਆਲੇ ਦੁਆਲੇ ਵਾਲੀਆਂ ਗਲੀਆਂ ਸਾਫ਼ ਕਰਨ ਨੂੰ ਵੀ ਉਸ ਬੰਦੇ ਤੋਂ ਕਹਿੰਦੇ ਹਾਂ ਤਾਂ ਕਿ ਵੀ ਅੱਗੇ ਦੀ ਉਹ ਇਹੋ ਜਿਹੀ ਗਲਤੀ ਦੁਬਾਰਾ ਨਾ ਕਰੇ